ਕਿਤਾਬ ਨੂੰ ਪੂਰਾ ਕਰਨ 'ਤੇ ਸਮਾਂ ਤਾਂ ਲੱਗਦਾ ਹੀ ਹੈ ਬਾਕੀ ਕਿਤਾਬ ਦੇ ਵਿੱਚ ਕਿੰਨੇ ਪੰਨੇ ਹਨ ਇਸ 'ਤੇ ਡਿਪੈਂਡ ਕਰਦਾ ਹੈ ਕਿਤਾਬ ਨੂੰ ਕਿਤਾਬ ਦੇ ਨੌਲੇਜ ਦੇ ਹਿਸਾਬ ਨਾਲ਼ ਵੀ ਪੜ੍ਹਿਆ ਜਾਂਦਾ ਹੈ ਜੇ ਇੰਟਰਸਟਿੰਗ ਹੋਵੇ ਤਾਂ ਉਸ 'ਤੇ ਜ਼ਿਆਦਾ ਟਾ ਸਮਾਂ ਲਾਇਆ ਜਾਂਦਾ ਬਾਕੀ ਮੈਂ ਇੱਕ ਘੰਟਾ ਪੂਰਾ ਬੈਠ ਕੇ ਪੜ੍ਹ ਸਕਦੀ ਹਾਂ ਪੜ੍ਹਨ ਲੱਗਿਆ ਮੈਂ ਜ਼ਿਆਦਾਤਰ ਆਪਦੇ ਵਿਚਾਰਾਂ ਦੇ ਅਨੁਸਾਰ ਵਾਲ਼ੀਆਂ ਕਿਤਾਬਾਂ ਹੀ ਪੜ੍ਹਦੀ ਹਾਂ ਮੇਰੇ ਕੋਲੋਂ ਪੜ੍ਹਨ ਲਈ ਮਾਸਿਕ ਜਾਂ ਹਫਤਾਵਾਰੀ ਟੀਚੇ ਤਾਂ ਨਹੀਂ ਹਨ ਪਰ ਮੈਂ ਜਿਹੜੀ ਕਿਤਾਬ ਪਸੰਦ ਆ ਜਾਵੇ ਉਸਨੂੰ ਜ਼ਰੂਰ ਪੜ੍ਹਦੀ ਹਾਂ